ਹਾਂਜੀ ਮੈਂ ਅਤਿਅੰਤ ਮੌਸਮ ਵਿੱਚ ਸ਼ੂਟਿੰਗ ਦੀ ਬਹੁਤ ਹੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਹੀ ਕਰਦੀ ਹਾਂ ਅਤੇ ਕਰਦੀ ਰਹਾਂਗੀ ਮੈਨੂੰ ਵੀ ਇਹੀ ਲੱਗਦਾ ਹੈ ਕਿ ਜਿਹੜਾ ਮੌਸਮ ਹੈ ਉਹ ਫੋਟੋ ਦੇ ਮੂਡ ਅਤੇ ਮਾਹੌਲ ਨੂੰ ਬਹੁਤ ਸੋਹਣੇ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇੱਕ ਸੋਹਣਾ ਮਨ ਅਤੇ ਸੋਹਣੀ ਤਸਵੀਰ ਜਿਹੜੀ ਹੈ ਉਹ ਆਪਸ ਦੇ ਵਿੱਚ ਬੜਾ ਹੀ ਮੇਲ ਖਾਂਦੀ ਹੈ ਅਤੇ ਸੋਹਣੇ ਤਰੀਕੇ ਦੇ ਨਾਲ ਹੀ ਇਹ ਜਿਹੜੀ ਚੀਜ਼ ਹੈ ਅੱਗੇ ਵੀ ਨਿਕਲ ਕੇ ਆਉਂਦੀ ਹੈ ਅੰਤਿਮ ਪਿਚਰ ਆਸ ਪਾਸ ਦੇ ਮੂਡ ਅਤੇ ਮਾਹੌਲ 'ਤੇ ਕਾਫੀ ਪ੍ਰਭਾਵਿਤ ਨਿਰਭਰ ਕਰਦੀ ਹੈ ਚਾਹੇ ਉਹ ਮੌਸਮ ਹੀ ਕਿਉਂ ਨਾ ਹੋਵੇ